ਹਾਂ ਸਾਨੂੰ ਮਾਨਸਿਕ ਸਿਹਤ ਸਮੱਸਿਆ ਬਾਰੇ ਪਤਾ ਜੋ ਕਿ ਮਨ ਅਤੇ ਦਿਮਾਗ ਨੂੰ ਡਿਸਟਰਬ ਕਰਦੀ ਹੈ ਅਤੇ ਕੁਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਬੰਦਾ ਆਪਣੇ ਆਪ 'ਚ ਸ਼ਾਂਤ ਜਿਹਾ ਰਹਿੰਦਾ ਚੁੱਪ ਚਾਪ ਰਹਿੰਦਾ ਤਾਂ ਇਹਦੇ ਹੱਲ ਲਈ ਕਈ ਸੰਸਥਾਵਾਂ ਬਣੀਆਂ ਹਨ ਡੋਕਟਰ ਵਗੈਰਾ ਵੀ ਸਕਾਈਟਰ ਵਗੈਰਾ ਵੀ ਹੁੰਦੇ ਹਨ ਅਤੇ ਅੱਜ ਕੱਲ੍ਹ ਲੋਕ ਇਸ ਚੀਜ਼ ਨੂੰ ਲੁਕਾਉਂਦੇ ਹਨ ਕਿ ਸ਼ਰਮਾਉਂਦੇ ਜਾਂ ਸਮਾਜ ਤੋਂ ਡਰਦੇ ਨਹੀਂ ਦੱਸਦੇ ਅਤੇ ਉਹ ਆਪਣੇ ਆਪ ਲਈ ਕਈ ਵਾਰ ਖ਼ਤਰਾ ਪੈਦਾ ਕਰਦੇ ਹਨ ਅਤੇ ਜਾਨ ਵੀ ਗਵਾ ਲੈਂਦੇ ਹਨ ਪਰ ਇਹ ਚੀਜ਼ ਸਾਨੂੰ ਡਰ ਕੇ ਜਾਂ ਲੁਕਾ ਕੇ ਨਹੀਂ ਰੱਖਣੀ ਚਾਹੀਦੀ ਅਤੇ ਇਸੇ ਚੀਜ਼ ਨੂੰ ਸਾਨੂੰ ਗੰਭੀਰਤਾ ਨਾ ਲੈਣਾ ਚਾਹੀਦਾ ਕਿਉਂਕਿ ਇਸ ਵਿੱਚ ਕੋਈ ਸੰਗ ਜਾਂ ਸ਼ਰਮ ਨਹੀਂ ਹੋਣੀ ਚਾਹੀਦੀ ਅਤੇ ਵਿਅਕਤੀ ਨੂੰ ਇਸ ਨਾਲ ਲੜਨ ਦੀ ਹਿੰਮਤ ਹੋਣੀ ਚਾਹੀਦੀ ਹੈ ਅਤੇ ਆਪਣੇ ਆਪ ਉੱਪਰ ਕੋਈ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਇਸ ਹਾਲਤ ਨੂੰ ਠੀਕ ਕਰਨਾ ਚਾਹੀਦਾ ਹੈ